ਪੰਜਾਬ ਵਿੱਚ ਟੈਕਨੋਲੋਜੀ ਦਾ ਬਹੁਤ ਹੀ ਪਰ ਮਹੱਤਵਪੂਰਨ ਪ੍ਰਭਾਵ ਪੈਂਦਾ ਜਾ ਰਿਹਾ ਹੈ ਜਿ ਜਿਵੇਂ ਜਿਵੇਂ ਟੈਕਨੋਲਜੀ ਐਡਵਾਂਸ ਹੁੰਦੀ ਜਾਂਦੀ ਹੈ ਇੱਥੋਂ ਦੇ ਵਪਾਰੀ ਜਾਂ ਸਥਾਨਕ ਟੈਕਨੋਲੋਜੀ ਸੈਕਟਰ ਵਿੱਚ ਵੀ ਐਡਵਾਂਸਮੈਂਟ ਹੋ ਰਹੀ ਹੈ ਜਿਵੇਂ ਕਿ ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਸਥਾਨਕ ਭਾਈਚਾਰਾ ਇੱਕ ਦੂਜੇ ਨਾਲ ਬਹੁਤ ਹੀ ਤਰੀਕੇ ਨਾਲ ਜੁੜਿਆ ਹੈ ਥਰੂ ਵਟਸਐਪ ਗਰੁੱਪਸ ਐਂਡ ਮੀਟਿੰਗਸ ਵਗੈਰਾ ਨਾਲ ਜੁੜਿਆ ਹੁੰਦਾ ਹੈ ਟੈਕ ਬੈਗ ਪੈਕਸ ਹੁੰਦੇ ਹਨ ਜਾਂ ਉਹਨਾਂ ਨੂੰ ਆਫਿਸ ਪ੍ਰੋਗਰਾਮਸ ਔਰਗਨਾਈਜ਼ ਕੀਤੇ ਜਾਂਦੇ ਹਨ ਜਿੰਨਾਂ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਸਥਾਨਕ ਸੈਕਟਰਾਂ ਦੇ ਸ ਭਾਈਚਾਰੇ ਦੇ ਬੰਦੇ ਆਉਂਦੇ ਹਨ ਅਤੇ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਹਨ ਅਤੇ ਹਰੇਕ ਤਰ੍ਹਾਂ ਦੀ ਐਡਵਾਂਸਮੈਂਟ ਬਾਰੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਨਵੇਂ ਤੋਂ ਨਵੀਂ ਸਥਾਨਕ ਟੈਕਨੋਲਜੀ ਬਾਰੇ ਰੋ ਸਥਾਨਕ ਟੈਕਨੋਲਜੀ ਅਤੇ ਊਰਜਾ ਪਾਉਂਦੇ ਹਨ